ਮੈਂ ਵਾਤਾਵਰਨ ਬਾਰੇ ਦੱਸਣਾ ਦੱਸ ਰਿਹਾ ਵਾਂ ਮੈਂ ਇਹੋ ਦੱਸਣਾ ਚਾਹੁੰਦਾ ਵੀ ਵਾਤਾਵਰਨ ਜਿਹੜਾ ਹੈਗਾ ਵੀ ਉਹ ਅੱਜ ਕੱਲ੍ਹ ਦਾ ਜਿਹੜਾ ਵਾਤਾਵਰਨ ਬਹੁਤ ਜ਼ਿਆਦਾ ਖ਼ਰਾਬ ਹੋਣ ਡਿਆ ਵਾ ਸਾਰਿਆਂ ਤੋਂ ਪਹਿਲਾਂ ਜਿੱਥੋਂ ਸਾਨੂੰ ਪਤਾ ਲੱਗਦਾ ਵੀ ਸਾਡੇ ਸਾਰਿਆਂ ਦੇ ਪਹਿਲਾਂ ਸਟਾਰਟਿੰਗ ਹੁੰਦੀ ਆ ਸਾਡੇ ਘਰ ਤੋਂ ਜਿਹਦੇ ਵਿੱਚ ਅਸੀਂ ਜਿੱਦਾਂ ਵੀ ਗੰਦਗੀ ਸਟਾਰਟ ਹੁੰਦੀ ਆ ਅਸੀਂ ਲਿਫ਼ਾਫ਼ੇ ਵਰਤਦੇ ਹਾਂ ਪਲਾਸਟਿਕ ਦੀਆਂ ਬੋਤਲਾਂ ਵਰਤਦੇ ਹਾਂ ਉਹਨਾਂ ਦੀ ਬਾਅਦ 'ਚੋਂ ਕਈਆਂ ਦੀ ਕਈ ਜਿਹੜੇ ਬਾਅਦ 'ਚੋਂ ਨਹੀਂ ਯੂਜ ਹੁੰਦੇ ਕਈ ਤਾਂ ਚਲੋ ਥੋੜ੍ਹੇ ਬਹੁਤ ਯੂਜ ਹੋ ਜਾਂਦੇ ਪਰ ਬਾਅਦ ਕਈ ਜਦ ਨਹੀਂ ਯੂਜ਼ ਹੁੰਦੇ ਉਹਨਾਂ ਨੂੰ ਅਸੀਂ ਇੱਦਾਂ ਹੀ ਪਲਾਟਾਂ ਵਿੱਚ ਸੁੱਟ ਦਿੰਦੇ ਹਾਂ ਜਾਂ ਅਸੀਂ ਇੱਦਾਂ ਹੀ ਅੱਗ ਨਾਲ਼ ਸਾੜ ਦਿੰਦੇ ਹਾਂ ਅਤੇ ਬਾਅਦ 'ਚੋਂ ਸਾਨੂੰ ਜਿਹੜੇ ਉਹਨਾਂ ਤੋਂ ਪੋਲਿਊਸ਼ਨ ਨਿਕਲਦਾ ਵਾ ਜਿਹੜੇ ਸਾਨੂੰ ਹਾਨੀਕਾਰਕ ਹੁੰਦੇ ਹਨ ਵਾਧੂ ਸਾਡੀ ਸਿਹਤ ਲਈ ਖਰਾਬ ਕਰ ਦਿੰਦੇ ਆ ਕਈ ਸਾਡੇ ਜਿਹੜੇ ਸ ਬੱਚੇ ਹੁੰਦੇ ਜਾਂ ਭਰਾ ਹੁੰਦੇ ਆ ਉਨ ਉਹਨਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ

ਫਿਰ ਕਈ ਜਿਹੜੇ ਹੁੰਦੇ ਰੀਸਾਈ ਯੂਜ ਹੋ ਜਾਂਦੇ ਆ ਉਹਨਾਂ ਨੂੰ ਸਾਨੂੰ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਆ ਜਿੱਦਾਂ ਪਲਾਸਟਿਕ ਦੀ ਬੋਤਲ ਹੋ ਗਿਆ ਲਿਫ਼ਾਫ਼ੇ ਹੋ ਗਏ ਇਹੋ ਜਿਹੀ ਸਾਨੂੰ ਇਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜੇ ਆਪਾਂ ਇਹੋ ਚੁਣੌਤੀਆਂ ਘ ਘੱਟ ਕਰਾਂਗੇ ਇਹੋ ਜਿਹੇ ਕੰਮ ਅਤੇ ਪੇੜ ਪੂੜ ਜ਼ਿਆਦਾ ਲਾਵਾਂਗੇ ਤੁਹਾਨੂੰ ਉਹਦੇ ਨਾਲ਼ ਸਾਨੂੰ ਪਾਣੀ ਸ਼ੁੱਧ ਮਿਲੇਗਾ ਸਾਡੀ ਓਜ਼ੋਨ ਪਰਤ ਸਹੀ ਹੋਊਗੀ ਫੈਕਟਰੀਆਂ ਤੋਂ ਜਿਹੜਾ ਧੂੰਆਂ ਨਿਕਲਦਾ ਵਾ ਉਹਨਾਂ ਦੇ ਜੇ ਅਸੀਂ ਘੱਟ ਵਰਤੋਂ ਕਰਾਂਗੇ ਤਾਂ ਉਹਨਾਂ ਨਾਲ਼ ਕਈਆਂ ਦੀ ਸਿਹਤ ਠੀਕ ਰਹੂੰਗੀ ਥੈਂਕ